ਹਾਂਜੀ ਖੇਡਾਂ ਇੱਕ ਜਿਹੜੇ ਹੁੰਦੀਆਂ ਉਹ ਵਿਦਿਆਰਥੀ ਦਾ ਇੱਕ ਅਹਿਮ ਹਿੱਸਾ ਹੁੰਦੀਆਂ ਸਨ ਜਿਵੇਂ ਕਿ ਮੇਰੇ ਖੁਦ ਦੇ ਫੈਮਿਲੀ ਮੈਂਬਰ ਦੇ ਵਿੱਚ ਜਿਵੇਂ ਕਿ ਮੇਰਾ ਕਜ਼ਨ ਹੈ ਚਾਚਾ ਜੀ ਦਾ ਬੇਟਾ ਜਿਹੜਾ ਕਿ ਖੇਡਾਂ ਨੂੰ ਬਹੁਤ ਹੀ ਪੜ੍ਹਾਈ ਦੇ ਨਾਲ ਨਾਲ ਬਹੁਤ ਹੀ ਮਹੱਤਵ ਦਿੰਦਾ ਹੈ ਜਿਵੇਂ ਕਿ ਉਹ ਖੇਡਾਂ ਦੇ ਵਿੱਚ ਬਹੁਤ ਹੀ ਰੁਚੀ ਰੱਖਦਾ ਹੈ ਆਪਣਾ ਕਰੀਅਰ ਸਮਝਦਾ ਹੈ ਉਹ ਸਕੂਲ ਦੇ ਵਿੱਚ ਆਪਣੀ ਖੇਡ ਦੇ ਵਿੱਚ ਬਹੁਤ ਜ਼ਿਆਦਾ ਪਾਰਟੀਸਪੇਟ ਕਰਦਾ ਹੈ ਅਤੇ ਉਹ ਆਪਣੀਆਂ ਖੇਡਾਂ ਨੂੰ ਮਤਲਬ ਬਹੁਤ ਹੀ ਚੰਗੇ ਤਰੀਕੇ ਨਾਲ ਖੇਡਦਾ ਹਰੇਕ ਟੂਰਨਾ ਵਿੱਚ ਪਾਰਟੀਸਪੇਟ ਕਰਦਾ ਹੈ ਆਪਣੀ ਚੰਗਾ ਮਤਲਬ ਹਿੱਸਾ ਲੈ ਕੇ ਆਪਣੇ ਵਧੀਆ ਕੈਰੀਅਰ ਬਣਾਉਂਦਾ ਉਹ ਮਤਲਬ ਹਰ ਇੱਕ ਉਹਨੂੰ ਐਂ ਲੱਗਦਾ ਕਿ ਜਿਵੇਂ ਮੈਂ ਖੇਡ ਵਿੱਚ ਨੈਸ਼ਨਲ ਪੱਧਰ 'ਤੇ ਵੀ ਖੇਡਾਂ ਅਤੇ ਮਤਲਬ ਨੈਸ਼ਨਲ ਪੱਧਰ 'ਤੇ ਜਿੱਤ ਕੇ ਆਪਦਾ ਮਤਲਬ ਵਧੀਆ ਕਰੀਅਰ ਬਣਾਵਾਂ ਵਧੀਆ ਕਰੀਅਰ 'ਤੇ ਫੋਕਸ ਕਰਾਂ ਅਤੇ ਜਿਹੜੇ ਸਕੂਲਾਂ ਵਿੱਚ ਵਿਦਿਆਰਥੀ ਹੁੰਦੇ ਹਨ ਜਿਨ੍ਹਾਂ ਨੂੰ ਖੇਡਾਂ ਖਿਡਾਈਆਂ ਜਾਂਦੀਆਂ ਸਕੂ ਉਹ ਵਧੀਆ ਆਪਣੇ ਮਤਲਬ ਖੇਡਾਂ ਵਿੱਚ ਪਾਰਟੀਸਪੇਟ ਕਰਦੇ ਹਨ ਖੇਡਦੇ ਸਨ ਅਤੇ ਨੈਸ਼ਨਲ ਪੱਧਰ 'ਤੇ ਜਾਂਦੇ ਸਨ ਅਤੇ ਜਿੱਤ ਕੇ ਆਉਂਦੇ ਸਨ ਜਿਹਦੇ ਨਾਲ ਉਹ ਆਪਣੀ ਫੈਮਲੀ ਅਤੇ ਵਿਦਿਆਰਥੀਆਂ ਵਿਦਿਆਰਥੀਆਂ ਦਾ ਨਾਮ ਰੋਸ਼ਨ ਕਰਦੇ ਸਨ ਜਿਹਦੇ ਵਿੱਚ ਉਹਨਾਂ ਨੂੰ ਮਤਲਬ ਵਧੀਆ ਬਹੁਤ ਹੀ ਵਧੀਆ ਫੀਲਿੰਗ ਆਉਂਦੀ ਸ ਜਿਹਦੇ ਨਾਲ ਉਹਨਾਂ ਦੇ ਮਤਲਬ ਸਕੂਲ ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ ਮਤਲਬ ਨੰਬਰ ਆਉਂਦੇ ਸਨ ਅਤੇ ਖੇਡਾਂ ਦੇ ਵਿੱਚ ਵੀ ਉਹ ਫਸਟ ਕਲਾਸ ਆਉਂਦੇ ਸਨ ਜਿਹਦੇ ਨਾਲ ਉਹਨਾਂ ਦੀ ਸਿਹਤ ਦੇ ਵਿਕਸਿਤ ਹੋਣ ਖਾਸ ਹੁੰਦਾ ਹੈ ਵਧੀਆ ਅਤੇ ਆਪਣੇ ਸਕੂਲ ਦੇ ਨਾਲ ਨਾਲ ਆਪਣੇ ਪਿੰਡ ਥਾਂ ਗਾਂਓ ਆਦਿ ਦਾ ਵੀ ਨਾਮ ਰੋਸ਼ਨ ਕਰਦੇ ਸਨ ਜਿਹਦੇ ਨਾਲ ਉਹਨਾਂ ਦੇ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਸਿਹਤ ਦਾ ਵੀ ਬਹੁਤ ਵਧੀਆ ਵਿਕਾਸ ਹੁੰਦਾ ਹੈ ਅਤੇ ਖੇਡਾਂ ਦੇ ਨਾਲ ਨਾਲ ਆਪਦੇ ਨੈਸ਼ਨਲ ਪੱਧਰ 'ਤੇ ਵੀ ਵਧੀਆ ਖੇਡ ਕੇ ਆਪਣੇ ਪਰਿਵਾਰ ਅਤੇ ਪਰਿਵਾਰ ਨੂੰ ਵਧੀਆ ਪ ਵਧੀਆ ਹੌਸਲਾ ਦਿੰਦੇ ਸਨ ਕਿ ਉਹ ਜ਼ਿੰਦਗੀ ਦੇ ਵਿੱਚ ਵਧੀਆ ਬਣ ਸਕਦੇ ਹਨ